ਮੈਂ ਛੋਟੇ ਹੁੰਦੇ ਕਾਫੀ ਗੇਮਾਂ ਵਿੱਚ ਆਪਣਾ ਇੰਟਰਸਟ ਸੀ ਮੇਰਾ ਕਿਉਂਕਿ ਛੋਟੇ ਹੁੰਦੇ ਕਾਫੀ ਗੇਮਾਂ ਵਿੱਚ ਸਾਡਾ ਇੰਟਰਸਟ ਹੁੰਦਾ ਕਿ ਮੈਂ ਆਹ ਵੀ ਕਰਤਾ ਉਹ ਵੀ ਕਰ ਇਸ ਕਰਕੇ ਛੋਟੀ ਗੇਮ ਛੋਟਿਆਂ ਹੁੰਦਿਆਂ ਮੈਂ ਦੋੜ ਵਿੱਚ ਕਾਫੀ ਜਾਂਦਾ ਹੁੰਦਾ ਸੀ ਕਿਉਂਕਿ ਹਾਈਟ ਮੇਰੀ ਲੰਬੀ ਸੀ ਅਤੇ ਮੈਨੂੰ ਦੌੜਨਾ ਕਾਫੀ ਪਸੰਦ ਸੀ ਅਤੇ ਕਾਫੀ ਕੋਸ਼ਿਸ਼ ਕੀਤੀ ਕਿ ਮੈਂ ਦੌੜਨ ਵਿੱਚ ਅੱਗੇ ਨਿਕਲਾਂ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਕਿ ਤੇਰੀ ਦੌੜ ਵੀ ਅੱਛੀ ਹੈ ਅਤੇ ਤੂੰ ਆਰਮੀ 'ਚ ਜਾ ਇਹ ਚੀਜ਼ਾਂ ਹੋਏ ਇਹ ਚੀਜ਼ਾਂ ਕਰ ਅਤੇ ਮੈਂ ਦੌੜਨ ਦੀ ਕੋਸ਼ਿਸ਼ ਕਰਦਾ ਸੀ ਪਰ ਹੌਲੀ ਹੌਲੀ ਹੌਲੀ ਹੌਲੀ ਮੇਰਾ ਉਹਦੇ ਵਿੱਚ ਜਿਹੜਾ ਇੰਟਰਸਟ ਘਟਦਾ ਗਿਆ ਮੇਰਾ ਫਿਰ ਹੌਲੀ ਇੰਟਰਸਟ ਕ੍ਰਿਕਟ 'ਚ ਜਾਗ ਗਿਆ ਕ੍ਰਿਕਟ 'ਚ ਮੇਰਾ ਕਾਫੀ ਇੰਟਰਸਟ ਕ੍ਰਿਕਟ 'ਚ ਵੀ ਕਾਫੀ ਹੱਦ ਤੱਕ ਤਾਂ ਭੱਜਣਾ ਹੀ ਪੈਂਦਾ ਕ੍ਰਿਕਟ 'ਚ ਵੀ ਭੱ ਭੱਜਣਾ ਪੈਂਦਾ ਅਤੇ ਉਹ 'ਚ ਮੇਰਾ ਇੰਟਰਸਟ ਕਾਫੀ ਵੱਧ ਗਿਆ ਅਤੇ ਅੱਜ ਤੱਕ ਮੇਰਾ ਕ੍ਰਿਕਟ 'ਚ ਇੰਟਰਸਟ ਰਿਹਾ ਹੁਣ ਮੇਰਾ ਦੌੜਨ 'ਚ ਕਾਫੀ ਘੱਟ ਗਿਆ ਕਿਉਂਕਿ ਹੁਣ ਕੰਮਕਾਰ ਵੀ ਕਰ ਕਰਦੇ ਹਾਂ ਅਤੇ ਹੁਣ ਫਿਰ ਉਸ ਹਿਸਾਬ ਦੀ ਰਿਹਾ ਨਹੀਂ ਕਿ ਆਪਾਂ ਇੰਨਾ ਭੱਜ ਸਕੀਏ ਸਾਹ ਚੜ੍ਹ ਜਾਂਦਾ ਸਾਹ ਪੱਕੇ ਨਹੀਂ ਹੈਗੇ ਅਤੇ ਕ੍ਰਿਕਟ ਵਿੱਚ ਮੇਰਾ ਕਾਫੀ ਇੰਟਰਸਟ ਰਿਹਾ ਕ੍ਰਿਕਟ ਮੈਂ ਕਾਫੀ ਦੇਰ ਤੱਕ ਖੇਡਦਾ ਰਹਿੰਦਾ ਵਾ ਉਹਦੇ ਵਿੱਚ ਮੈਨੂੰ ਸਾਹ ਨਹੀਂ ਚੜ੍ਹਦਾ ਉਹਦੇ ਮੈਂ ਕਾਫੀ ਦੇਰ ਤੱਕ ਖੇਡਦਾ ਰਹਿੰਦਾ ਵਾ ਅਤੇ ਕਾਫੀ ਅੱਛਾ ਐਕਸਪੀਰੀਅੰਸ ਰਹਿੰਦਾ ਮੇਰਾ ਇਹਦੇ ਵਿੱਚ ਕ੍ਰਿਕਟ 'ਚ ਕ੍ਰਿਕਟ 'ਚ ਕ੍ਰਿਕਟ ਦਾ ਇੱਕ ਬੰਦਾ ਖੇਡਦਾ ਅਤੇ ਇੱਕ ਉਹਦੇ ਵਿੱਚ ਤੁਹਾਡਾ ਇੱਕ ਸਟੈਮਿਨਾ ਵੱਧਦਾ ਕ੍ਰਿਕਟ ਵਿੱਚ ਇਸ ਕਰਕੇ ਸਾਨੂੰ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਚਾਹੀਏ ਦੌੜਨਾ ਕ੍ਰਿਕਟ ਖੇਡਣਾ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਤੁਹਾਡਾ ਸਟੈਮੀਨਾ ਵਧੇ ਤੁਹਾਡਾ ਜਿਹੜਾ ਬੋਡੀ ਤਰ ਤੁਰਦੀ ਰਹੇ ਮੈਂ ਕਾਫੀ ਚੀਜ਼ਾਂ ਛੋਟੇ ਹੁੰਦੇ ਕੀਤੀਆਂ ਹੋਈਆਂ ਇਹ ਚੀਜ਼ਾਂ ਹਰ ਚੀਜ਼ ਵਿੱਚ ਮੈਂ ਆਪਣਾ ਪਾਰਟੀਸਪੇਟ ਕੀਤਾ ਹੋਇਆ ਜਿੱਦਾਂ ਫੁੱਟਬੋਲ 'ਚ ਵੀ ਪਾਸਟ ਪਾਰਟੀਸਪੇਟ ਕੀਤਾ ਹੋਇਆ ਮੈਂ ਕਿਉਂਕਿ ਛੋਟੇ ਹੁੰਦੇ ਹੁੰਦਾ ਨਾ ਕਿ ਆਪਾਂ ਹਰ ਚੀਜ਼ ਵਿੱਚ ਖੇਡ ਲਈਏ ਅਤੇ ਫੁੱਟਬੋਲ ਵੀ ਮੈਂ ਖੇਡਦਾ ਹੁੰਦਾ ਸੀ ਛੋਟੇ ਹੁੰਦੇ ਫੁੱਟਬੋਲ ਬੈਡਮਿੰਟਨ ਜੇ ਹੋ ਗਿਆ ਬੈਡਮਿੰਟਨ ਤੋਂ ਇਲਾਵਾ ਕਿੰਨੀਆਂ ਚੀਜ਼ਾਂ ਜਿਹੜੀਆਂ ਮੈਂ ਖੇਡੀਆਂ ਹੋਈਆਂ ਹਨ ਪਰ ਮੇਰਾ ਜਿਹੜਾ ਮੇਨ ਇੰਟਰਸਟ ਰਿਹਾ ਉਹ ਸਿਰਫ ਕ੍ਰਿਕਟ ਵਿੱਚ ਹੀ ਰਿਹਾ ਇਸ ਕਰਕੇ ਕਾਫੀ ਅੱਛਾ ਲੱਗਦਾ ਮੈਨੂੰ ਕ੍ਰਿਕਟ ਖੇਡਣਾ